ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਮਿਲਜੂਗਾ ਜੀ ਤੁਹਾਡੀ ਯੂਨੀਵਰਸਿਟੀ ਕਿਹੜੀ ਹੈ ਔਰ ਕੋਰਸ ਕਿਹੜਾ ਤੁਹਾਡਾ ਠੀਕ ਹੈ ਜੀ ਹਾਂਜੀ ਵੈਸੇ ਅਸੀਂ ਨੋਟਸ ਰੱਖਦੇ ਨਹੀਂ ਹੈ ਪਰ ਜਿੱਦਾਂ ਹੀ ਸਾਨੂੰ ਕੋਈ ਡਿਮਾਂਡ ਆਵੇਗੀ ਤਾਂ ਅਸੀਂ ਤੁਹਾਨੂੰ ਬੈਕ ਕਾਲ ਕਰਕੇ ਤੁਹਾਡੇ ਤੋਂ ਨੋਟਸ ਮੰਗਵਾ ਲਵਾਂਗੇ ਹਾਂਜੀ ਵੈਸੇ ਤਾਂ ਕੁਸ਼ਚਨ ਪੇਪਰ ਹਰ ਸਾਲ ਚੇਂਜ ਹੋ ਜਾਂਦੇ ਆ ਪਰ ਕੋਈ ਨਹੀਂ ਤੁਸੀਂ ਬੁੱਕਸ ਦੇ ਨਾਲ ਹੀ ਦੇ ਦਿਓ ਉਹ ਵੀ ਹਾਂਜੀ ਮਿਲ ਜਾਣਗੀਆਂ ਉਹਨਾਂ ਦਾ ਕਿਹੜਾ ਬੋਰਡ ਹੈ ਹਾਂਜੀ ਮਿਲ ਜੂੰਗੀਆਂ ਜੀ ਕੋਈ ਨਹੀਂ ਤੁਸੀਂ ਇੱਕ ਵਾਰ ਦੁਕਾਨ 'ਤੇ ਆ ਜਿਓ ਫਿਰ ਆਪਾਂ ਗੱਲ ਕਰ ਲਵਾਂਗੇ ਹਾਂਜੀ ਤੁਹਾਨੂੰ ਦੋ ਜਾਂ ਢਾਈ ਸੌ ਰੁਪਏ ਵਿੱਚ ਐਡ ਕਰਨੇ ਪੈਣਗੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਕਦੇ ਵੀ ਦੁਕਾਨ 'ਤੇ ਆਜਿਓ